ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਇਹ ਪਹਿਰਾਵਾ ਪਹਿਨਿਆ ਜਾਂਦਾ ਹੈ ਜਿਵੇਂ ਕਿ ਕੁੜਤਾ ਚਾਦਰਾ ਕੈਂਠਾ ਕੜਾ ਰੁਮਾਲ ਨੋਕ ਵਾਲੀ ਜੁੱਤੀ ਤੁਰਲੇ ਵਾਲੀ ਪੱਗ ਆਦਿ ਇਹ ਭੰਗੜਾ ਵੱਖੋ ਵੱਖ ਤਿਉਹਾਰਾਂ 'ਤੇ ਪਾਇਆ ਜਾਂਦਾ ਹੈ ਅਤੇ ਇਹ ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਅਤੇ ਇਹ ਭੰਗੜਾ ਵਿਸਾਖੀ ਦੇ ਮੇਲੇ 'ਤੇ ਵੀ ਪਾਇਆ ਜਾਂਦਾ ਹੈ ਵਿਸਾਖੀ ਵੇਲੇ ਵੀ ਪਾਇਆ ਜਾਂਦਾ ਹੈ ਅਤੇ ਇਹ ਭੰਗੜਾ ਪੰਜਾਬੀ ਬਹੁਤ ਹੀ ਇੱਛਾ ਅਤੇ ਇੱਛਾ ਨਾਲ ਪਾਉਂਦੇ ਹਨ ਭੰਗੜਾ ਪਾਉਂਦੇ ਸਮੇਂ ਉਹ ਬਹੁਤ ਸੋਹਣੇ ਲੱਗ ਰਹੇ ਹੁੰਦੇ ਹਨ ਅਤੇ ਉਹ ਆਪਣੇ ਆਪ ਨੂੰ ਵੀ ਇਸ ਪਹਿਰਾਵੇ ਲਈ ਆਕਰਸ਼ਿਤ ਕਰਦੇ ਹਨ ਅਤੇ ਲੋਕਾਂ ਨੂੰ ਵੀ ਆਕਰਸ਼ਿਤ ਕਰਦੇ ਹਨ ਕਿਉਂਕਿ ਉਹ ਆਪਣੇ ਆਪ ਵਿੱਚ ਬਹੁਤ ਸੁੰਦਰ ਲੱਗ ਰਹੇ ਹੁੰਦੇ ਹਨ